ਹੈਲੋ ਹਾਂ ਕਿਆ ਹਾਲ ਹੈ ਹੋਰ ਵਧੀਆ ਘਰ ਪਰਿਵਾਰ ਸਾਰੇ ਹੋਰ ਕਿਆ ਕਰਦਾ ਅੱਜ ਕੱਲ੍ਹ ਯਾਰ ਤੇਰੇ ਤੇ ਨਾ ਇੱਕ ਸਲਾਹ ਜਿਹੀ ਲੈਣੀ ਸੀ ਕੰਮ ਜਾ ਇੱਕ ਤੇਰੇ ਨਾਲ ਅਸੀਂ ਨਾ ਛੁੱਟੀਆਂ ਨੇ ਸਾਨੂੰ ਗਰਮੀਆਂ ਦੀਆਂ ਅਸੀਂ ਹਜ਼ੂਰ ਸਾਹਿਬ ਵੱਲ ਜਾਣ ਦਾ ਪ੍ਰੋਗਰਾਮ ਜਿਹਾ ਬਣਾਇਆ ਵਾ ਤਾ ਅਸੀਂ ਹੈਗੇ ਤੇ ਪੰਜ ਸੱਤ ਕੁ ਜਾਣੇ ਇੱਕ ਘਰ ਦੇ ਮੈਂਬਰ ਵੀ ਹੈਗੇ ਤੇ ਸਾਡੇ ਨਾ ਹੁਣ ਯਾਰ ਛੁੱਟੀਆਂ ਹੋਗੀਆ ਕੈਂਸਲ ਉਹਦੇ ਕਰਕੇ ਹੁਣ ਸਾਨੂੰ ਟਿਕਟਾਂ ਨਾ ਜਿਹੜੀਆਂ ਉਹ ਰੱਦ ਕਰਾਉਣੀਆਂ ਪੈਣੀਆਂ ਉਹਦੇ ਕਰਕੇ ਯਾਰ ਮੇਰਾ ਭਰਾ ਚੱਕਰ ਜਿਹਾ ਪੈ ਗਿਆ ਹੁਣ ਹੈਂ ਉੱਧਰ ਕੰਮ ਦਾ ਵੀ ਜ਼ਰੂਰੀ ਹੈ ਹੈਂ ਉੱਧਰ ਹੁਣ ਫਿਰ ਦੇਖਾਂਗੇ ਕਦੇ ਜਾ ਆਵਾਂਗੇ ਉਹਦਾ ਕਰਕੇ ਮੇਰਾ ਭਰਾ ਪਤਾ ਕਰਕੇ ਦੱਸੀ ਯਾਰ ਕਿਸੇ ਤੋਂ ਐਂ ਕੈ ਕੈਫੈ ਵਾਲੇ ਨੂੰ ਪੁੱਛ ਲੈ ਵੀ ਕਿਆ ਕਿਆ ਪ੍ਰੋਸੀਜਰ ਇਹਦਾ ਤੈਨੂੰ ਆਪਣਾ ਪੀ ਐਨ ਆਰ ਨੰਬਰ ਦੇ ਦਿੰਦਾ ਆਈਡੀ ਨੰਬਰ ਦੇ ਦਿੰਦਾ ਨਾਲ ਨਾਲੇ ਪਾਸਪੋਰਟ ਦੇ ਭੇਜ ਦਿੰਦਾ ਤੈਨੂੰ ਮੈਂ ਹੁਣੇ ਹੀ ਤੂੰ ਮੇਰਾ ਭਰਾ ਪਤਾ ਕਰਕੇ ਦੱਸੀ ਯਾਰ ਵੀ ਕਿਆ ਕਿਆ ਪਸੀਜਰ ਕਿੱਦਾਂ ਕਿੱਦਾਂ ਹੋਣੀ ਆ ਇਹ ਵੀ ਕਿਆ ਸਾਨੂੰ ਇਹਦਾ ਕੋਈ ਰਿਫੰਡ ਮਿਲ ਸਕਦਾ ਏ ਹੈਂ ਮੈਨੂੰ ਦੱਸੀਂ ਮੇਰਾ ਭਰਾ ਯਾਰ ਜ਼ਰੂਰੀ ਹੈ ਕਿਉਂਕਿ ਪਹਿਲਾ ਪ੍ਰੋਗਰਾਮ ਹੈਗਾ ਤਾਂ ਜਾਣੇ ਦਾ ਊਂ ਅਰਜੈਟਲੀ ਸਾਨੂੰ ਕੈਂਸਲ ਕਰਨਾ ਪਿਆ ਇਹਦੇ ਕਰਕੇ ਮਾੜਾ ਔਖਾ ਜਿਹਾ ਹੋ ਗਿਆ ਬੋਂਡ ਸਿਸਟਮ ਜਿਹਾ ਤੈਨੂੰ ਪਤਾ ਹੀ ਹੈ ਹੈਂ ਹੁਣ ਦੱਸੀ ਮੇਰਾ ਭਰਾ ਮਾੜਾ ਪਤਾ ਕਰਕੇ ਠੀਕ ਹੈ ਮੇਰਾ ਭਰਾ ਓਕੇ ਸਤਿ ਸ਼੍ਰੀ ਅਕਾਲ